ਹੈਲੋ ਸਤਿ ਸ਼੍ਰੀ ਅਕਾਲ ਜੀ ਗਾਵਾਂ ਵਿੱਚ ਕੈਲਸ਼ੀਅਮ ਦੀ ਕਮੀ ਗਾਵਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਉਸ ਉਸ ਦੇ ਖਾਣ ਪੀਣ ਦਾ ਸਭ ਉਹਦਾ ਜੇ ਨਾ ਧਿਆਨ ਦਿੱਤਾ ਜਾਵੇ ਖਾਣ ਪੀਣ ਦਾ ਤਾਂ ਕਰਕੇ ਬਹੁਤ ਹੀ ਜ਼ਿਆਦਾ ਗਾਵਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਪਾਈ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਗਾਵਾਂ ਦੇ ਵਿੱਚ ਉਸ ਦਾ ਖਾਣ ਪੀਣ ਦਾ ਧਿਆਨ ਦੇਵੋ ਖਾਣ ਪੀਣ ਫੀਡ ਚੋਕਰ ਉਹਦਾ ਚੰਗੀ ਤਰ੍ਹਾਂ ਧਿਆਨ ਦਿੱਤਾ ਜਾਵੇ ਅਤੇ ਗਾਵਾਂ ਦੇ ਵਿੱਚ ਇਹ ਹਿਸਾਬ 'ਚ ਕੈਲਸ਼ੀਅਮ ਦੀ ਕਮੀ ਨਹੀਂ ਪਾਈ ਜਾ ਸਕਦੀ ਅਤੇ ਅਤੇ ਇੱਕ ਇੱਕ ਆਉਂਦਾ ਇੰਗਲਿਸ਼ ਦੇ ਵਿੱਚ ਉਹਨੂੰ ਇੰਟਰਾਬੀਨਸ ਕਹਿੰਦੇ ਆ ਅਤੇ ਗੁਨੁਕੋਨੀਟ ਜੇ ਉਹ ਵੀ ਦਿੱਤਾ ਜਾਵੇ ਗਾਵਾਂ ਨੂੰ ਤਾਂ ਫਿਰ ਕੈਲਸ਼ੀਅਮ ਦੀ ਕਮੀ ਬਿਲਕੁਲ ਨਹੀਂ ਹੋ ਸਕਦੀ ਨਾਲੇ ਦੂਜੀ ਗੱਲ ਇਹ ਆ ਕਿ ਉਸ ਦਾ ਉਮਰ ਦਾ ਤਕਾਜ਼ਾ ਵੀ ਠੀਕ ਹੋਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜੀ ਉਸ ਦਾ ਕੀ ਨਾਮ ਨਹੀਂ ਆਉਂਦਾ ਖਾਣ ਪੀਣ ਵਧੀਆ ਹੋਵੇ ਅਤੇ ਦੁੱਧ ਵੀ ਬਰਾਬਰ ਦੇਵੇਗੀ ਕੈਲਸ਼ੀਅਮ ਦੀ ਕਮੀ ਬਿਲਕੁਲ ਨਹੀਂ ਉਹਨੂੰ ਹੋਵੇਗੀ ਅਤੇ ਇਸ ਦੇ ਲੱਛਣ ਇਹਦਾ ਇਹਦਾ ਡਾਕਟਰੀ ਇਲਾਜ ਤੁਹਾਨੂੰ ਦੱਸਿਆ ਹੈ ਕਿ ਇਹਦਾ ਖਾਣ ਪੀਣ 'ਤੇ ਇੰਟਰਰਾਮੀਨਸ ਅਤੇ ਗੁਲੂਕੋਨੇਟ ਦਿੱਤਾ ਜਾਵੇ ਅਤੇ ਗਾਂ ਬਿਲਕੁਲ ਹੀ ਠੀਕ ਦੁੱਧ ਦੇਵੇਗੀ ਅਤੇ ਅਤੇ ਕੈਲਸ਼ੀਅਮ ਦੀ ਕਮੀ ਨਹੀਂ ਪਾਈ ਜਾਵੇਗੀ ਜੀ ਬਿਲਕੁਲ